ਜਿਵੇਂ ਜਿਵੇਂ ਤਕਨੀਕੀ ਵਿਕਾਸ ਹੋ ਰਿਹਾ ਹੈ ਤਾਂ ਬਹੁਤ ਸਾਰੇ ਲੋਕ ਇਲੈਕਟ੍ਰੀਕਲ ਸਮਾਨ ਖਰੀਦਦੇ ਹੈਗੇ ਨੇ ਕੋਈ ਕੰਪਿਊਟਰ ਨਾਲ਼ ਰਿਲੇਟਡ ਚੀਜ਼ਾਂ ਖਰੀਦਦੇ ਨੇ ਕੁਝ ਮੋਬਾਇਲ ਨਾਲ਼ ਰਿਲੇਟਡ ਚੀਜ਼ਾਂ ਖਰੀਦ ਰਹੇ ਨੇ ਅਤੇ ਇਸ ਤਰ੍ਹਾਂ ਵੱਖ ਵੱਖ ਲੋਕਾਂ ਨੂੰ ਵੱਖ ਵੱਖ ਢੰ ਢੰਗਾਂ ਨਾਲ਼ ਮੁਸ਼ਕਿਲਾਂ ਆਉਂਦੀਆਂ ਨੇ ਅਤੇ ਜਿੰਨ੍ਹਾਂ ਵੀ ਸਾਡੇ ਤੋਂ ਹੋ ਸਕਦਾ ਜਿੰਨ੍ਹੀ ਕੁ ਸਾਨੂੰ ਜਾਣਕਾਰੀ ਹੈ ਅਸੀਂ ਉਹਨਾਂ ਨੂੰ ਹੱਲ ਕਰਦੇ ਹਾਂ ਜਦੋਂ ਤੱਕ ਕੰਪਿਊਟਰ ਹੈ ਉਹ 'ਚ ਨਹੀਂ ਚੱਲ ਰਿਹਾ ਤਾਂ ਉਹਨਾਂ ਦੀ ਕਈ ਤਰੀਕੇ ਨਾਲ਼ ਤਕਨੀਕੀ ਸਹਾਇਤਾ ਕੀਤੀ ਜਾਂਦੀ ਹੈ ਅਤੇ ਅਗਰ ਕੋਈ 'ਤੇ ਚੱਲਦਾ ਤਾਂ ਉਸ ਤਰੀਕੇ ਨਾਲ਼ ਅਸੀਂ ਉਹਦੀ ਹੈਲਪ ਕਰਦੇ ਹੀ ਹਾਂ ਅਤੇ ਇਸ ਬਾਰੇ ਬਹੁਤ ਸਾਰੀ ਹੈਲਪ ਹੈਗੀ ਸਾਨੂੰ ਗੂਗਲ ਤੋਂ ਮਿਲ ਜਾਂਦੀ ਹੈ ਅਤੇ ਅਸੀਂ ਉਹਦਾ ਸ ਉਹਦੀ ਵੀ ਸਹਾਰਾ ਲੈਂਦੇ ਹਾਂ ਤਾਂ ਜਾਂ ਸਾਡੇ ਕੋਈ ਸਰਕਲ 'ਚ ਕੋਈ ਕੋਈ ਜਾਣਕਾਰ ਹੈਗਾ ਉਸ ਚੀਜ਼ ਦਾ ਅਸੀਂ ਉਹਤੋਂ ਵੀ ਹੈਲਪ ਲੈ ਲਈ ਦੀ ਹੈ ਇਸ ਤਰ੍ਹਾਂ ਅਸੀਂ ਜਿੰਨ੍ਹਾਂ ਹੋ ਸਕਦਾ ਹੈ ਅਸੀਂ ਛੋਟੇ ਤਾਂ ਹੱਲ ਕਰ ਹੀ ਸਕਦੇ ਹਾਂ ਅਤੇ ਵੱਡੇ ਤਕਨੀਕੀ ਮੁੱਦੇ ਜਿਹੜੇ ਆਉਂਦੇ ਉਹ ਵੀ ਕੋਸ਼ਿਸ਼ ਕਰੀ ਦੀ ਹੱਲ ਕਰਨ ਦੀ ਅਤੇ ਅਗਰ ਉਹ ਨਹੀਂ ਹੱਲ ਹੁੰਦੇ ਤਾਂ ਅਸੀਂ ਫਿਰ ਮਕੈਨਿਕ ਕੋਲ਼ ਚਲੇ ਜਾਂਦੇ ਹਾਂ